ਸਾਡਾ ਮਨਪਸੰਦ ਜੋ ਮੌਸਮ ਹੈ ਉਹ ਬਰਸਾਤ ਵਾਲਾ ਮੌਸਮ ਹੈ ਮਾਨਸੂਨ ਵਾਲਾ ਮੌਸਮ ਹੈ ਉਹ ਸਾਨੂੰ ਬਹੁਤ ਹੀ ਵਧੀਆ ਲੱਗਦਾ ਹੈ ਕਿਉਂਕਿ ਜਦੋਂ ਬਰਸਾਤ ਹੁੰਦੀ ਹੈ ਤਾਂ ਲੋਕ ਕੀ ਕਰਦੇ ਹਨ ਕੀ ਆਪਣੀਆਂ ਆਪਣੇ ਘਰਾਂ 'ਚ ਬਹਿ ਕੇ ਪਕੌੜੇ ਖਾਂਦੇ ਹਨ ਅਤੇ ਹੋਰ ਵੀ ਵਧੀਆ ਵਧੀਆ ਚੀਜ਼ਾਂ ਦਾ ਜੋ ਹੈ ਉਹ ਆਨੰਦ ਲੈਂਦੇ ਹਨ ਤਾਂ ਮਨਪਸੰਦ ਮੌਸਮ ਇਸ ਕਰਕੇ ਹੈ ਕਿ ਮੀਂਹ ਜ਼ਿਆਦਾ ਪੈਣ ਕਰਕੇ ਕਿਸੇ ਟਾਈਮ ਜੋ ਲੋਕ ਦਫ਼ਤਰ ਜਾਂਦੇ ਹਨ ਜਾਂ ਸਕੂਲ ਜਾਂਦੇ ਹਨ ਉਹਨਾਂ ਨੂੰ ਬਰਸਾਤਾਂ ਕਰਕੇ ਛੁੱਟੀ ਹੋ ਜਾਂਦੀ ਹੈ ਵੈਸੇ ਵੀ ਬਰਸਾਤੀ ਮੌਸਮ ਜੋ ਹੈ ਉਹ ਬਹੁਤ ਹੀ ਹਿਸਾਬ ਨਾਲ ਆਉਂਦਾ ਹੈ ਉਸ ਦਾ ਕਾਰਨ ਇਹ ਹੈ ਕਿ ਲੋਕ ਜੋ ਹੈ ਉਹ ਵਾਹਵਾ ਪਕੌੜੇ ਖਾਂਦੇ ਹਨ ਜਾਂ ਜਲੇਬੀਆਂ ਖਾਂਦੇ ਹਨ ਜਾਂ ਹੋਰ ਵੀ ਹੈ ਉਸ ਮੌਸਮ ਦਾ ਆਨੰਦ ਮਾਣਦੇ ਹਨ ਇਸ ਇੱਕ ਗੱਲ ਇਹ ਵੀ ਹੈ ਕਿ ਜੋ ਬਰਸਾਤ ਦਾ ਮੌਸਮ ਹੈ ਉਹ ਬਹੁਤ ਹੀ ਰੋਮੈਂਟਿਕ ਹੁੰਦਾ ਹੈ ਅਤੇ ਹੋਰ ਜੇ ਆਪਾਂ ਕਹਿ ਸਕੀਏ ਅਜੋ ਸਰਦੀ ਦਾ ਮੌਸਮ ਹੈ ਉਹ ਵੀ ਬਹੁਤ ਵਧੀਆ ਹੁੰਦਾ ਹੈ ਗਰਮੀ ਦੇ ਮੌਸਮ ਨਾਲੋਂ ਇਸ ਕਰਕੇ ਸਾਨੂੰ ਜਿਹਾ ਉਹ ਮਾਨਸੂਨ ਵਾਲਾ ਮੌਸਮ ਜਾਂ ਸਰਦੀਆਂ ਵਾਲਾ ਮੌਸਮ ਜੋ ਹੈ ਉਹ ਬਹੁਤ ਹੀ ਪਸੰਦ ਹੈ